ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਰ ਮੈਂ ਜਾਣਾ ਸਰ ਆਪਣੇ ਅੰਮ੍ਰਿਤਸਰ ਉਹ ਨਹੀਂ ਨਹੀਂ ਇਹ ਅਮ ਇਹ ਨਹੀਂ ਇਹ ਅੰਮ੍ਰਿਤਸਰ ਨਹੀਂ ਜਾਣੀ ਨਹੀਂ ਨਹੀਂ ਹੁਣ ਮੈਂ ਜਿੱਦਾਂ ਮਨ ਜਲਨ ਮੈਂ ਹੁਣ ਅੰਮ੍ਰਿਤਸਰ ਜਾਣਾ ਸੀ ਮੀਟਿੰਗ 'ਤੇ ਅਤੇ ਮਤਲਬ ਕਿੱਥੋਂ ਮੈਨੂੰ ਬੱਸ ਕਿੱਥੋਂ ਮਿਲੇਗੀ ਜਿਹੜਾ ਮੈਂ ਟੈਮ ਟੂ ਟੈਮ ਪਹੁੰਚ ਸਕਾ ਉੱਥੇ ਮਤਲਬ

ਅੰਮ੍ਰਿਤਸਰ ਦੀ ਬੱਸ ਮਿਲ ਜਾਏਗੀ ਇੱਥੋਂ ਦੀ ਹੈ ਨਾ ਚਲੋ ਮਿਹਰਬਾਨੀ ਸੋਰੀ ਮੈਂ ਨਾ ਬੋਰਡ ਪੜ੍ਹਿਆ ਨਹੀਂ ਸੀ ਅੱਗੇ ਕਾਹਲੀ ਕਾਹਲੀ 'ਚ ਮੈਂ ਚੜ ਗਿਆ ਸੀ ਸੋਰੀ ਤਾਂ ਕਰਕੇ ਚਲੋ ਮਲਕਪੁਰ ਤਾਰ ਚਲੋ ਮਲਕਪੁਰ ਤੱਕ ਦੀ ਕੱਟ ਦਿਓ ਫਿਰ ਮੈਂ ਓਥੋਂ ਆਪੇ ਲੈ ਲਵਾਂਗਾ ਜਿੱਦਾਂ ਕਿੰਨੇ ਪੈਸੇ ਜੀ ਠੀਕ ਲਓ ਜੀ ਠੀਕ